ਹੈਲੋ ਟਰਾਂਸਪੋਰਟ ਕੰਪਨੀ ਵਾਲੇ ਬੋਲ ਰਹੇ ਆ ਅਸੀਂ ਰਿਸ਼ੀਕੇਸ਼ ਯਾਤਰਾ ਕਰਨੀ ਚਾਹੁੰਦੇ ਹਾਂ ਆਪਣੇ ਕਿ ਅਸੀਂ ਤੁਹਾਡੇ ਟਰਾਂਸਪੋਰਟ ਰਾਹੀਂ ਯਾਤਰਾ ਕਰੀਏ ਅਸੀਂ ਆਪਣੀ ਯਾਤਰਾ ਪੂਰੇ ਪਰਿਵਾਰ ਸਮੇਤ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਨਾ ਆਵੇ ਇਸ ਲਈ ਅਸੀਂ ਤੁਹਾਡੀ ਟਰਾਂਸਪੋਰਟ 'ਤੇ ਭਰੋਸਾ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਟਰਾਂਸਪੋਰਟ ਰਾਹੀਂ ਹੀ ਆਪਣੀ ਯਾਤਰਾ ਪੂਰੀ ਕਰੀਏ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਪੈਸੇ ਸਬੰਧੀ ਥੋੜ੍ਹੀ ਛੋਟ ਕਰੋ ਧੰਨਵਾਦ ਜੀ